ਮੈਂ ਸ਼ੀਤਲ ਕੁਮਾਰੀ ਵਾਸੀ ਮਿਰਜ਼ਾਪੁਰ ਪਠਾਨਕੋਟ ਜ਼ਿਲ੍ਹੇ ਦੀ ਰਹਿਣ ਵਾਲੀ ਹਾਂ ਮੈਂ ਦੱਸ ਰਹੀ ਹਾਂ ਕਿ ਪੰਜਾਬੀ ਸੱਭਿਆਚਾਰ ਵਿੱਚ ਫੁਲਕਾਰੀ ਦੀ ਕਢਾਈ ਦੀ ਮਹੱਤਤਾ ਫੁਲਕਾਰੀ ਇੱਕ ਚੁੰਨੀ ਨੂੰ ਕਿਹਾ ਜਾਂਦਾ ਹੈ ਜੋ ਕਿ ਸੱਜ ਵਿਆਹੀ ਆਪਣੇ ਸਿਰ ਨੂੰ ਕਜਦੀ ਹੈ ਇਹ ਪੁਰਾਤਨ ਰਿਵਾਜ਼ ਵਿੱਚ ਬੜੀ ਮਹੱਤਤਾ ਦਰਸਾਈ ਗਈ ਹੈ ਫੁਲਕਾਰੀ ਦੀ ਕਢਾਈ ਕੁੜੀਆਂ ਕੱਢਦੀਆਂ ਸਨ ਪਰ ਅੱਜ ਫੁਲਕਾਰੀ ਦਾ ਰਿਵਾਜ਼ ਘਟਦਾ ਜਾ ਰਿਹਾ ਹੈ ਫੁਲਕਾਰੀ ਕਈ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਵੱਖ ਵੱਖ ਕਿਸਮਾਂ ਦੀ ਫੁਲਕਾਰੀ ਹੁੰਦੀ ਹੈ ਜਿਵੇਂ ਕਸੀਦਾ ਫੁਲਕਾਰੀ ਗੁੱਟ ਫੁਲਕਾਰੀ ਵੰਗ ਫੁਲਕਾਰੀ ਸਮਾਜ ਫੁਲਕਾਰੀ ਆਦਿ ਫੁਲਕਾਰੀਆਂ ਸਾਡੇ ਸਮਾਜ ਵਿੱਚ ਪ੍ਰਚਲਿਤ ਹਨ ਪਰ ਅੱਜ ਕੁੜੀਆਂ ਬਿਲਕੁਲ ਹੀ ਕੋਈ ਫੰਕਸ਼ਨ ਜਾਂ ਕੋਈ ਵਿਆਹ ਸ਼ਾਦੀ ਵਿੱਚ ਫੁਲਕਾਰੀ ਲੱਭਦੀਆਂ ਹਨ ਜੋ ਕਿ ਹਰ ਕਿਸੇ ਕੋਲ ਨਹੀਂ ਹੁੰਦੀ ਉਹ ਸਾਡੇ ਸਮਾਜ ਦਾ ਇੱਕ ਬੜਾ ਹੀ ਵਧੀਆ ਚਾਹ ਹੈ ਪੁਰਾਤਨ ਔਰਤਾਂ ਇਸਨੂੰ ਸਮਾਜ ਵਿੱਚ ਪ੍ਰਸਿੱਧ ਹੋਣ ਦਾ ਰਿਵਾਜ਼ ਕਈ ਤਰ੍ਹਾਂ ਦੀਆਂ ਗੱਲਾਂ ਵੱਲ ਇਸ਼ਾਰਾ ਕਰਦੀਆਂ ਹਨ ਇਸ ਤਰ੍ਹਾਂ ਕਿਹਾ ਜਾਂਦਾ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਸੱਭਿਆਚਾਰ ਵਿੱਚ ਫੁਲਕਾਰੀ ਦੀ ਕਢਾਈ ਬੜੀ ਹੀ ਵਧੀਆ ਹੈ ਬੜੀ ਹੀ ਨੇਕ ਹੈ ਇੱਥੇ ਲੋਕ ਇਸਨੂੰ ਪਹਿਲਾਂ ਬੜਾ ਹੀ ਪਸੰਦ ਕਰਦੇ ਸਨ ਪਰ ਅੱਜ ਇਸ ਦਾ ਪ੍ਰਚਲਿਤ ਇਸ ਦੀ ਸਮਾਜ ਵਿੱਚ ਜੇ ਕਿਹਾ ਜਾਏ ਕਿ ਅੱਜ ਵੀ ਬੜੀ ਹੀ ਮਹੱਤਤਾ ਹੈ ਧੰਨਵਾਦ ਜੀ